ਮੇਰਾ ਪਹਿਲਾ ਪ੍ਰੋਡਕਟ ਮੈਨੇ ਐਮੇਜ਼ੋਨ ਤੋਂ ਈਅਰਫੋਨਸ ਮੰਗਵਾਏ ਸਨ ਇਹ ਈਅਰਫੋਨਸ ਜੈਬਰੋਨਿਕਸ ਦੇ ਸਨ ਜੈਬਰੋਨਿਕਸ ਦੇ ਜ਼ੈੱਡ ਸਾਊਂਡ ਬੋਮ ਵਨ ਇਹਨਾਂ ਦੇ ਵਿੱਚ ਤੇਰਾਂ ਐੱਮ ਐੱਮ ਦੇ ਡਰਾਈਵਰ ਸੀ ਅਤੇ ਇਹ ਨੀਲੇ ਰੰਗ ਦੇ ਸਨ ਇਹਨਾਂ ਦਾ ਡਿਜ਼ਾਇਨ ਬਹੁਤ ਹੀ ਵਧੀਆ ਸੀ ਅਤੇ ਇਹ ਕੰਨਾਂ ਵਿੱਚ ਬਹੁਤ ਚੰਗੀ ਤਰ੍ਹਾਂ ਫਿੱਟ ਹੋ ਜਾਂਦੇ ਸਨ ਇਹ ਈਅਰਫੋਨ ਟਚ ਕੰਟਰੋਲ ਦੇ ਨਾਲ ਸਨ ਅਤੇ ਇਹ ਦਿਵਾਲੀ ਸੇਲ ਦੇ ਉੱਤੇ ਮੈਨੂੰ ਫਿਫਟੀ ਪਰਸੈਂਟ ਡਿਸਕਾਊਂਟ 'ਤੇ ਮਿਲੇ ਸਨ ਜਿਸ ਨਾਲ ਇਹ ਮੈਨੂੰ ਸੱਤ ਸੌ ਰੁਪਏ ਦੇ ਕਰੀਬ ਮਿਲੇ ਸਨ ਇਹਨਾਂ ਈਅਰਫੋਨਸ ਦੀ ਆਵਾਜ਼ ਬਹੁਤ ਹੀ ਵਧੀਆ ਸੀ ਇਹ ਈਅਰਫੋਨਸ ਦੀ ਆਵਾਜ਼ ਫੁੱਲ ਵੋਲੀਅਮ 'ਤੇ ਵੀ ਨਹੀਂ ਫੜਦੀ ਸੀ ਅਤੇ ਇਸ ਦਾ ਬੇਸ ਅਤੇ ਟਰੈਵਲ ਦੀ ਫੰਕਸ਼ਨੈਲਿਟੀ ਬਹੁਤ ਹੀ ਵਧੀਆ ਹੈ ਇਹਨਾਂ ਏਅਰਫੋਨਸ ਦਾ ਬੈਟਰੀ ਬੈਕਅਪ ਤਕਰੀਬਨ ਦਸ ਘੰਟੇ ਦਾ ਹੈ ਅਤੇ ਕੇਸ ਦੇ ਨਾਲ ਇਹ ਤਿੰਨ ਤੋਂ ਚਾਰ ਦਿਨ ਆਰਾਮ ਨਾਲ ਕੱਢ ਜਾਂਦੇ ਹਨ ਇਹ ਈਅਰਫੋਨਸ ਦੇ ਵਿੱਚ ਟਾਈਪ ਸੀ ਚਾਰਜਿੰਗ ਹੈ ਅਤੇ ਇਹ ਈਅਰਫੋਨਸ ਬਲੂਟੁੱਥ ਫਾਈਵ ਨੂੰ ਸਪੋਰਟ ਕਰਦੇ ਹਨ ਇਹਨਾਂ ਈਅਰਫੋਨਸ ਦੀ ਕਿਸੇ ਵੀ ਡਿਵਾਈਸ ਨਾਲ ਕਨੈਕਟੀਵਿਟੀ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਉਂਦੀ ਇਹ ਈਅਰਫੋਨਸ ਦੇ ਵਿੱਚ ਲਾਈਟ ਸੈਂਸਰਸ ਵੀ ਨੇ ਇਹ ਬੈਟਰੀ ਇੰਡੀਕੇਟਰ ਲਾਈਟ ਲਾਈਟ ਜਗਾ ਕੇ ਦੱਸਦੇ ਹਨ ਅਤੇ ਕਨੈਕਟੀਵਿਟੀ ਦੇ ਉੱਤੇ ਵੀ ਅਲੱਗ ਅਲੱਗ ਰੰਗਾਂ ਦੀਆਂ ਲਾਈਟਾਂ ਚੱਲਣ ਨਾਲ ਇਹ ਦੱਸ ਦਿੰਦੇ ਹਨ ਕਿ ਇਹ ਕਿਸੇ ਵੀ ਡਿਵਾਈਸ ਨਾਲ ਕਨੈਕਟਿਡ ਹਨ ਜਾਂ ਨਹੀਂ